ਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਤੁਹਾਨੂੰ ਵੀ ਮਤਲਬ ਅਸੀਂ ਅਸੀਂ ਲੋਕ ਕੀ ਕਰਦੇ ਹਾਂ ਕਿ ਸਾਨੂੰ ਆਪਾਂ ਆਪਣੇ ਘਰਾਂ ਵਿੱਚ ਸਫਾਈ ਰੱਖਦੇ ਹਾਂ ਜਦੋਂ ਅਸੀਂ ਬਾਹਰ ਜਾਂਦੇ ਹਾਂ ਅਤੇ ਸਾਨੂੰ ਬਹੁਤ ਗੰਦਗੀ ਵਗੈਰਾ ਨਜ਼ਰ ਆਉਂਦੀ ਹੈ ਇਸ ਕਰਕੇ ਸਾਡਾ ਵਾਤਾਵਰਨ ਇੱਥੇ ਦਾ ਬਹੁਤ ਗੰਦਾ ਹੈ ਪੰਜਾਬ ਦਾ ਵਾਤਾਵਰਨ ਬਹੁਤ ਜ਼ਿਆਦਾ ਗੰਦਾ ਹੈ ਅਤੇ ਸ਼ਹਿਰਾਂ ਵਿੱਚ ਜ਼ਿਆਦਾ ਗੰਦਗੀ ਮਚਾਈ ਜਾਂਦੀ ਹੈ ਜਿਸ ਵਿੱਚੋਂ ਵੀ ਦੇਖੋ ਉੱਥੇ ਵੀ ਗੰਦਗੀ ਹੁੰਦੀ ਹੈ ਤਾਂ ਕਿ ਇਸ ਕਰਕੇ ਅਸੀਂ ਮਤਲਬ ਸਾਡਾ ਵਾਤਾਵਰਨ ਅਸੀਂ ਸਾਫ ਰੱਖਣਾ ਚਾਹੀਦਾ ਹੈ ਸਾਨੂੰ ਮਤਲਬ ਸਹੀ ਤਰੀਕੇ ਨਾਲ ਰਹਿਣ ਸਹਿਣ ਆਪਣਾ ਆਲਾ ਦੁਆਲਾ ਸਹੀ ਸਾਫ ਰੱਖਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਜਿੱਧਰ ਵੀ ਜਾਂਦੇ ਹਾਂ ਘੁੰਮਣ ਫਿਰਣ ਜਾਂ ਕਿਤੇ ਵੀ ਅਸੀਂ ਸਾਨੂੰ ਗੰਦਗੀ ਹੀ ਨਜ਼ਰ ਆਉਂਦੀ ਹੈ ਜਦੋਂ ਵੀ ਅਸੀਂ ਪਹਾੜਾਂ ਵੱਲ ਜਾਂ ਕਿਤੇ ਵੀ ਜਾਂਦੇ ਹਾਂ ਤਾਂ ਬਹੁਤ ਜ਼ਿਆਦਾ ਗੰਦਗੀ ਹੁੰਦੀ ਹੈ ਸਾਡੇ ਸ਼ਹਿਰਾਂ ਵਿੱਚ ਵੀ ਬਹੁਤ ਹੀ ਜ਼ਿਆਦਾ ਗੰਦਗੀ ਹੁੰਦੀ ਹੈ ਅਸੀਂ ਪਿੰਡਾਂ ਵਿੱਚ ਆਪਣੇ ਪਿੰਡ ਵਿੱਚ 'ਚ ਸਫਾਈ ਹੁੰਦੀ ਹੈ ਸ਼ਹਿਰਾਂ ਵਿੱਚ ਬਹੁਤ ਗੰਦਗੀ ਹੁੰਦੀ ਹੈ ਸਾਡਾ ਵਾਤਾਵਰਨ ਜਦੋਂ ਵੀ ਅਸੀਂ ਬਾਹਰ ਜਾਂਦੇ ਹਾਂ ਟਰੈਫਿਕ ਦਾ ਜੋ ਵੀ ਪ੍ਰਦੂਸ਼ਣ ਵਗੈਰਾ ਬੜਾ ਗੰਦੇ ਗੰਦਗੀ ਫੈਲੀ ਹੋਈ ਹੋਈ ਹੈ ਅਸੀਂ ਆਪਣਾ ਵਾਤਾਵਰਨ ਪੂਰੀ ਤਰ੍ਹਾਂ ਸਾਫ ਰੱਖਣਾ ਚਾਹੀਦਾ ਤਾਂ ਕਿ ਸਾਨੂੰ ਬਿਮਾਰੀਆਂ ਤੋਂ ਬਚ ਸਕੀਏ ਮੱਛਰ ਮੱਖੀ ਤੋਂ ਬਚ ਸਕੀਏ ਆਪਣੇ ਬੱਚਿਆਂ ਨੂੰ ਵੀ ਬਚਾ ਸਕੀਏ ਸਾਨੂੰ ਆਪਣੇ ਵਾਤਾਵਰਨ ਦੀ ਪੂਰੀ ਤਰ੍ਹਾਂ ਸਫਾਈ ਰੱਖਣੀ ਚਾਹੀਦੀ ਹੈ ਤਾਂ ਕਿ ਅਸੀਂ ਪੂਰੀ ਤਰ੍ਹਾਂ ਆਪਣੇ ਘਰ ਵਿੱਚ ਦੀ ਸਫਾਈ ਆਪਣੀ ਗਲੀ 'ਚ ਨਾਲੀਆਂ 'ਚ ਸਫਾਈ ਰੱਖਣੀ ਚਾਹੀਦੀ ਹੈ ਅੱਜ ਕੱਲ੍ਹ ਲੋਕ ਕੀ ਕਰਦੇ ਆ ਕਿ ਆਪਣੇ ਘਰਾਂ ਦੀ ਸਫਾਈ ਰੱਖ ਲੈਂਦੇ ਆ ਬਾਹਰ ਵਿੱਚ ਗੰਦਗੀ ਫੈਲਾਉਂਦੇ ਹਨ ਬਾਹਰ ਜਾ ਕੇ ਬਹੁਤ ਜ਼ਿਆਦਾ ਗੰਦਗੀ ਫੈਲਦੀ ਹੈ ਸਾਨੂੰ ਸਾਡਾ ਵਾਤਾਵਰਨ ਸਾਫ ਨਹੀਂ ਰਹਿੰਦਾ ਸਾਨੂੰ ਬੜਾ ਗੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡਾਂ ਵਿੱਚ ਜਾ ਕੇ ਵੀ ਅਤੇ ਸ਼ਹਿਰਾਂ ਵਿੱਚ ਵੀ ਬਹੁਤ ਜ਼ਿਆਦਾ ਗੰਦਗੀ ਹੁੰਦੀ ਹੈ ਔਰ ਸਾਨੂੰ ਆਪਣਾ ਵਾਤਾਵਰਨ ਸਾਫ ਰੱਖਣਾ ਚਾਹੀਦਾ ਪੰਜਾਬ ਦਾ